ਭੋਜਨ ਨਾਲ ਸਬੰਧਿਤ ਕਈ ਪ੍ਰੰਪਰਾਵਾਂ ਹਨ ਜੋ ਸਾਡੇ ਸ ਵੈਸੇ ਤਾਂ ਪਰ ਸਾਡੇ ਸਿੱਖ ਮਰ ਮਰਿਆਦਾ ਅਨੁਸਾਰ ਜਿਹੜਾ ਭੋਜਨ ਹੈ ਬਣਾਉਂਦੇ ਸਮੇਂ ਸਿਰ ਢੱਕ ਕੇ ਭੋਜਨ ਬਣਾਉਣਾ ਅਤੇ ਸਿਰ ਢੱਕ ਕੇ ਹੀ ਖਾਣਾ ਇੱਕ ਤ ਸਿੱਖਾਂ ਦੀ ਅਲੱਗ ਤੋਂ ਪ੍ਰੰਪਰਾ ਹੈ ਅਤੇ ਬਾਕੀ ਜਿਹੜੇ ਅੰਧਵਿਸ਼ਵਾਸਾਂ ਦੀ ਗੱਲ ਕਰੀਏ ਤਾਂ ਅੱ ਬਹੁਤ ਜ਼ਿਆਦਾ ਸਰਾਧ ਮਨਾਏ ਜਾਂਦੇ ਨੇ ਕੀ ਪਿੱਤਰਾਂ ਨੂੰ ਪੂਜਿਆ ਜਾਂਦਾ ਹੈ ਉਨ੍ਹਾਂ ਨੂੰ ਖਾਣਾ ਖਲਾਇਆ ਜਾਂਦਾ ਹੈ ਕਾਵਾਂ ਨੂੰ ਖਾਣਾ ਖਲਾਇਆ ਜਾਂਦਾ ਹੈ ਇਹ ਇੱਕ ਅੰਧਵਿਸ਼ਵਾਸ ਹੈ ਜੋ ਕਿ ਲੋਕ ਇਸ ਤੋਂ ਉੱਪਰ ਨਹੀਂ ਉੱਠ ਰਹੇ ਹਨ